ਚਾਰ ਜਨਵਰੀ ਦੋ ਹਜ਼ਾਰ ਪੰਦਰਾਂ ਵੀਹ ਮਾਰਚ ਦੋ ਹਜ਼ਾਰ ਸੌਲ੍ਹਾਂ ਤੇਈ ਸਪਟੰਬਰ ਦੋ ਹਜ਼ਾਰ ਅਠਾਰਾਂ ਗਿਆਰ੍ਹਾਂ ਨਵੰਬਰ ਦੋ ਹਜ਼ਾਰ ਵੀਹ ਵੀਹ ਦਸੰਬਰ ਦੋ ਹਜ਼ਾਰ ਬਾਈ